ਮੈਂ ਆਪਣੇ ਰੋਜ਼ਾਨਾ ਜੀਵਨ ਵਿੱਚ ਆਪਣੀ ਡਰਾਇੰਗਾਂ ਦੀ ਜਿਹੜੀ ਪ੍ਰੇਰਨਾ ਹੈ ਉਹ ਸੋਸ਼ਲ ਮੀਡੀਆ ਤੋਂ ਪ੍ਰਾਪਤ ਕਰਦੀ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਰੀਲਾਂ ਅਤੇ ਪੋਸਟਾਂ ਸ਼ੋ ਹੁੰਦੀਆਂ ਹਨ ਜਿਹੜੀ ਵੱਡੇ ਆਰਟਿਸਟਾਂ ਨੇ ਆਪਣੇ ਡਰਾਇੰਗਾਂ ਅਤੇ ਪੇਂਟਿੰਗਾਂ ਦੀ ਪਾਈ ਹੁੰਦੀ ਹੈ ਉਸਨੂੰ ਦੇਖ ਕੇ ਵਧੀਆ ਪੇਂਟਿੰਗਾਂ ਅਤੇ ਡਰਾਇੰਗਾਂ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ ਮੈਂ ਅਭਿਆਸ ਕਰਕੇ ਉਹਨਾਂ ਵਰਗੀ ਡਰਾਇੰਗਾਂ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਜਿਹੜੀ ਸਾਡੀ ਅਸਲ ਜੀਵਨ ਦੀ ਡਰਾਇੰਗ ਹੈ ਅਤੇ ਜਿਹੜੀ ਸਾਡੀ ਕਲਪਨਾ ਦੀ ਡਰਾਇੰਗ ਹੈ ਉਹਦੇ ਵਿੱਚ ਕੁਝ ਅੰਤਰ ਇਹ ਹੈ ਕਿ ਜਿਹੜੀ ਸਾਡੀ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀਂ ਕੋਈ ਡਰਾਇੰਗ ਬਣਾਉਂਦੇ ਹਾਂ ਤਾਂ ਉਹ ਚੀਜ਼ਾਂ ਵਿੱਚ ਸਾਡੇ ਪੇੜ ਪੌਦੇ ਹੋ ਗਏ ਅਸਮਾਨ ਹੋ ਗਿਆ ਕੁਦਰਤ ਹੋ ਗਈ ਜਾਨਵਰ ਹੋ ਗਏ ਇਹ ਸਭ ਚੀਜ਼ਾਂ ਜਿਹੜੀ ਸਾਡੇ ਬਾਹਰਲੀਆਂ ਸੁੰਦਰਤਾ ਨੇ ਉਹਨੂੰ ਦੇਖ ਕੇ ਸਾਡੀ ਜਿਹੜੀ ਜੀਵਨ ਦੀ ਡਰਾਇੰਗਾਂ ਹੈ ਜੀਵਨ ਤੋਂ ਪ੍ਰੇਰਨਾ ਲੈ ਕੇ ਡਰਾਇੰਗਾਂ ਬਣਦੀਆਂ ਹਨ ਅਤੇ ਜਿਹੜੀ ਸਾਡੀ ਕਲਪਨਾ ਦੀ ਡਰਾਇੰਗਾਂ ਹੁੰਦੀਆਂ ਹਨ ਇਹ ਸਾਡੇ ਅੰਦਰਲੇ ਸੁੰਦਰਤਾ ਨੂੰ ਦਰਸਾਉਂਦੀਆਂ ਹਨ ਕਿ ਸਾਡੇ ਮਨ ਦੇ ਅੰਦਰ ਕਿੰਨੀ ਸੁੰਦਰਤਾ ਹੈ ਅਸੀਂ ਕਲਪਨਾ ਕਰਦੇ ਹਾਂ ਪਰੀਆਂ ਦੀ ਅਸੀਂ ਕਲਪਨਾ ਕਰਦੇ ਹਾਂ ਸੋਹਣੇ ਜਿਹੇ ਘਰ ਦੀ ਜਿਹੜਾ ਇੱਕ ਨਦੀ ਦੇ ਕਿਨਾਰੇ ਵਸਿਆ ਹੋਵੇ ਜਾ ਕੋਈ ਇੱਦਾਂ ਦੀ ਚੀਜ਼ ਜਾ ਕੋਈ ਜੰਨਤ ਵਸੀ ਹੋਵੇ ਜਾ ਕੋਈ ਇੱਦਾਂ ਦੀ ਚੀਜ਼ ਜਿਹੜੀ ਉਂਝ ਤਾਂ ਅਸਲ ਜੀਵਨ ਵਿੱਚ ਨਹੀਂ ਹੈ ਪਰ ਸਾਡੀ ਕਲਪਨਾ ਵਿੱਚ ਜੀਵਿਤ ਹੈ ਅਸੀਂ ਸੋਚਦੇ ਹਾਂ ਪਰੀਆਂ ਬਾਰੇ ਰਾਕਸ਼ਸ਼ਾਂ ਬਾਰੇ ਸੋਹਣੀਆਂ ਸੋਹਣੀਆਂ ਚੀਜ਼ਾਂ ਬਾਰੇ ਜੋ ਅਸੀਂ ਬਣਾ ਕੇ ਅਤੇ ਆਪਣੀ ਡਰਾਇੰਗ ਲਈ ਕਲਪਨਾ ਵਾਲੀ ਪ੍ਰੇਰਨਾ ਲੈ ਸਕਦੇ ਹਾਂ